ਮੈਂ ਤਾਂ ਖਾਣਾ ਖਾ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਕਿਚਨ ਸਾਫ ਕਰਕੇ ਰੱਖ ਲੈਂਦੀ ਹਾਂ ਕਿਚਨ ਸਾਫ ਹੋ ਗਿਆ ਕੜਾਹੀ ਰੱਖੀ ਕੜਾਹੀ ਗਰਮ ਕੀਤੀ ਅਤੇ ਤੇਲ ਪਾਇਆ ਉੱਧਰੋਂ ਮੈਂ ਸਬਜ਼ੀਆਂ ਕੱਟ ਲਈਆਂ ਫਟਾਫਟ ਜੇ ਆਲੂ ਗਾਜਰਾਂ ਮਟਰ ਬਣਾਉਣੇ ਹੋਣ ਆਲੂ ਕੱਟ ਲਏ ਗਾਜਰਾਂ ਕੱਟ ਲਈਆਂ ਮਟਰ ਕੱਟ ਲਏ ਅਤੇ ਨਾਲ ਹੀ ਉੱਧਰ ਆਪਣਾ ਜਿਹੜਾ ਆਪਾਂ ਲਸਣ ਪਾਨੇ ਪਿਆਜ਼ ਪਾਉਂਦੇ ਹਾਂ ਫਟਾਫਟ ਪਿਆਜ਼ ਲਸਣ ਕੱਟ ਕੇ ਫਟਾਫਟ ਉਹਨੂੰ ਗਰੈਂਡ ਕਰਕੇ ਅਤੇ ਕੜਾਹੀ 'ਚ ਤੇਲ ਪਾਇਆ ਇੰਨੀ ਚਿਰ ਉਹ ਸੜ ਜਾਂਦਾ ਏ ਅਤੇ ਬਸ ਸਬਜ਼ੀ ਦੀ ਤਿਆਰੀ ਕਰ ਦਿੰਦੇ ਹਾਂ ਉਹਦੇ ਵਿੱਚ ਪਾ ਦਿੰਦੇ ਹਾਂ ਸਭ ਤੋਂ ਪਹਿਲਾਂ ਕਿ ਖਾਣਾ ਖਾ ਬਣਾਉਣ ਤੋਂ ਪਹਿਲਾਂ ਸਾਫ ਸਫਾਈਆਂ ਦਾ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਜ਼ਰੂਰੀ ਏ ਸਬਜ਼ੀਆਂ ਨੂੰ ਧੋਣਾ ਵੀ ਜ਼ਰੂਰੀ ਹੈ ਸਾਫ ਸੁਥਰੀਆਂ ਕਿਉਂਕਿ ਮਿੱਟੀ ਘੱਟਾ ਬਜ਼ਾਰ ਦੀਆਂ ਸਬਜ਼ੀਆਂ ਬਹੁਤ ਕੁਝ ਲੱਗਾ ਹੁੰਦਾ ਉਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਵਾ ਪੈਂਦਾ ਏ ਠੀਕ ਹੈ ਨਾ ਅਤੇ ਸ ਸਭ ਤੋਂ ਪਹਿਲਾਂ ਸਾਫ ਸਫਾਈ ਦੀ ਲੋੜ ਹੈ ਇਸੇ ਲਈ ਇਸ ਕੋਈ ਵੀ ਸਬਜ਼ੀ ਬਣਾਉਣ ਤੋਂ ਪਹਿਲਾਂ ਸਾਫ ਸਫਾਈ ਸਭ ਤੋਂ ਜ਼ਿਆਦਾ ਜ਼ਰੂਰੀ ਹੋਣੀ ਵੀ ਚਾਹੀਦੀ ਹੈ ਤੇਲ ਗਰਮ ਕਰਕੇ ਆਪਾਂ ਸਬਜ਼ੀ ਧਰ ਦਿੱਤੀ ਏ ਆਰਾਮ ਨਾਲ ਆਪਣਾ ਮਨ ਵੀ ਸ਼ਾਂਤ ਰਹਿਣਾ ਚਾਹੀਦਾ ਏ ਖਾਣਾ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਮਨ ਦੀ ਸ਼ਾਂਤੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਜੇ ਮਨ ਸ਼ਾਂਤ ਨਾ ਹੋਇਆ ਤਾਂ ਖਾਣਾ ਵੀ ਨਹੀਂ ਸਹੀ ਬਣਨਾ ਜੇ ਮਨ ਤੁਹਾਡਾ ਖੁਸ਼ ਹੈ ਤਾਂ ਖਾਣਾ ਵੀ ਵਧੀਆ ਵਧੀਆ ਖੁਸ਼ੀ ਖੁਸ਼ੀ ਨਾਲ ਬਣਨਾ ਸਬਜ਼ੀ ਮਜ਼ੇ ਮਜ਼ੇ ਨਾਲ ਸਬਜ਼ੀਆਂ ਕੱਟਣੀਆਂ ਮਜ਼ੇ ਮਜ਼ੇ ਨਾਲ ਬਣ ਜਾਣੀਆਂ ਏ ਅਤੇ ਖੁਸ਼ੀ ਖੁਸ਼ੀ ਆਪਾਂ ਲੋਕਾਂ ਨੇ ਖਾ ਵੀ ਲੈਣੀ ਹੈ ਇਸੇ ਤਰ੍ਹਾਂ ਪਰਿਵਾਰ ਵੀ ਖੁਸ਼ ਫੈਮਲੀ ਵੀ ਖੁਸ਼ ਇਸੇ ਲਈ ਸਾਫ ਸੁਥਰਾ ਖਾਣਾ ਸਿਹਤ ਲਈ ਵੀ ਜ਼ਰੂਰੀ ਹੈ ਪਰਿਵਾਰ ਲਈ ਵੀ ਜ਼ਰੂਰੀ ਹੈ ਉਹਨਾਂ ਦੀਆਂ ਖੁਸ਼ੀਆਂ ਲਈ ਵੀ ਜ਼ਰੂਰੀ ਹੈ ਅਤੇ ਸਾਡੇ ਖੁਸ਼ ਰਹਿਣ ਲਈ ਵੀ ਜ਼ਰੂਰੀ ਹੈ ਓਕੇ